ਹੈਲੋ ਹਾਂਜੀ ਭਾਅ ਜੀ ਮੈਂ ਬੜੀ ਦੇਰ ਦੀ ਕੈਬ ਬੁੱਕ ਕਰਵਾਈ ਹੋਈ ਆ ਦਿੱਲੀ ਵਾਸਤੇ ਆਪਾਂ ਦਿੱਲੀ ਵਾਸਤੇ ਨਿਕਲਣਾ ਹੈਗਾ ਅਤੇ ਬੜੀ ਦੇਰ ਦਾ ਉਡੀਕ ਕਰ ਰਿਹਾ ਅਤੇ ਹਾਲੇ ਤੱਕ ਤੁਹਾਡੀ ਕੈਬ ਨਹੀਂ ਆਈ ਮੈਨੂੰ ਤਾਂ ਦੱਸ ਦਿਓ ਕਿੰਨੀ ਦੇਰ 'ਚ ਤੁਸੀਂ ਆਉਣਾ ਨਹੀਂ ਤਾਂ ਸਾਡਾ ਬਹੁਤ ਜ਼ਿਆਦਾ ਕੰਮ ਲੇਟ ਹੋ ਜਾਣਾ ਮੇਰੀ ਟਰੇਨ ਮਿਸ ਹੋ ਜਾਣੀ ਹੈ ਸਟੇਸ਼ਨ ਤੱਕ ਜਾਣਾ ਹੈਗਾ ਅਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਪਈ ਆ ਮੇਰੀ ਟਰੇਨ ਅੱਗੋਂ ਮਿਸ ਹੋ ਜਾਵੇਗੀ ਅਤੇ ਇੰਨਾ ਸਮਾਂ ਤੁਸੀਂ ਕਿਉਂ ਲੈਂਦੇ ਪਏ ਹੋ ਤੇ ਮੈਨੂੰ ਰੀਜਨ ਦੱਸੋ ਅਤੇ ਕਿਉਂ ਤੁਸੀਂ ਇੰਨਾ ਕਿਉਂਕਿ ਮੈਂ ਬਹੁਤ ਜ਼ਿਆਦਾ ਦੇਰ ਹੋ ਗਈ ਹੈ ਅਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਮੇਰਾ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਅਤੇ ਟਾਈਮ 'ਤੇ ਪੁੱਜਣਾ ਵੀ ਅਤੇ ਮੈਂ ਬਹੁਤ ਦੇਰ ਹੋ ਗਈ ਹੈ ਉਡੀਕ ਕਰਦੇ ਲਈ ਅਤੇ ਹਾਲੇ ਤੱਕ ਮੈਂ ਇਸ ਕਰਕੇ ਪਹਿਲਾਂ ਬੁਕਿੰਗ ਕਰਵਾਈ ਹੋਈ ਸੀ ਅਤੇ ਹਾਲੇ ਤੱਕ ਮੇਰੀ ਆਈ ਨਹੀਂ ਹੈ ਅਤੇ ਮੈਨੂੰ ਕੋਈ ਮੈਸੇਜ ਨਹੀਂ ਆ ਰਿਹਾ ਤੇ ਮੈਂ ਤੁਸੀਂ ਇੰਨਾ ਸਮਾਂ ਕਿਉਂ ਲੈ ਰਹੇ ਹੋ ਮੈਨੂੰ ਦੱਸੋ ਤੁਸੀਂ ਕਿੰਨੀ ਦੇਰ 'ਚ ਪਹੁੰਚੋਗੇ ਅਤੇ ਮੈਂ ਛੇਤੀ ਤੋਂ ਛੇਤੀ ਪਹੁੰਚਣਾ ਹੈਗਾ ਅਤੇ ਮੈਂ ਨਿਕਲਣਾ ਹੈਗਾ ਅੱਗੇ ਦਿੱਲੀ ਵਾਸਤੇ ਤੇ ਤਾਂ ਕਿ ਮੇਰਾ ਕੋਈ ਨੁਕਸਾਨ ਨਾ ਹੋ ਜਾਵੇ ਅਤੇ ਮੈਨੂੰ ਇਸ ਬਾਰੇ ਛੇਤੀ ਦੱਸੋ ਕਿ ਤੁਸੀਂ ਕਿੰਨੀ ਦੇਰ 'ਚ ਆਓਗੇ ਅਤੇ ਕਿੰਨੀ ਕੁ ਦੇਰ ਲਗਾਉਣੀ ਹੈਗੀ